ਸਤਿ ਸ਼੍ਰੀ ਅਕਾਲ ਜੀ ਮੈਂ ਜਸਵੀਰ ਗੱਲ ਕਰ ਰਹੀ ਹਾਂ ਅਤੇ ਮੈਂ ਫਿਲਹਾਲ ਇੱਕ ਕਰੀਮ ਦਾ ਔਰਡਰ ਦਿੱਤਾ ਸੀ ਅਤੇ ਉਹ ਮੈਨੂੰ ਮਿਲ ਗਈ ਹੈ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਮੈਂ ਇਸ ਸਰਵਿਸ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ ਕਿਉਂਕਿ ਇਸਦੀ ਪੇਸ਼ਕਾਰੀ ਇਸਦੀ ਪੈਕਿੰਗ ਬਹੁਤ ਹੀ ਬੁਰੀ ਹਾਲਤ ਵਿੱਚ ਮੈਨੂੰ ਮਿਲੀ ਹੈ ਅਤੇ ਉਸ ਤੋਂ ਇਲਾਵਾ ਕਰੀਮ ਦੀ ਕੁਆਂਟਿਟੀ ਜੋ ਕਿ ਮੈਨੂੰ ਦਸ ਗ੍ਰਾਮ ਦੱਸੀ ਗਈ ਸੀ ਬਟ ਉਸ ਤੋਂ ਵੀ ਜਦੋਂ ਮੈਂ ਉਸਨੂੰ ਖੋਲ ਕੇ ਦੇਖਿਆ ਤਾਂ ਮੈਨੂੰ ਇਹ ਪੰਜ ਗ੍ਰਾਮ ਤੋਂ ਵੀ ਘੱਟ ਲੱਗ ਰਹੀ ਹੈ ਅਤੇ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਇਹ ਕਰੀਮ ਆਪਣੇ ਹੱਥ ਦੇ ਥੋੜ੍ਹੇ ਹੱਥ ਦੇ ਉੱਤੇ ਲਗਾਈ ਤਾਂ ਮੈਨੂੰ ਉਸ ਓਨੇ ਹਿੱਸੇ ਦੇ ਵਿੱਚ ਰੈਸ਼ਿਸ਼ ਅਤੇ ਬਹੁਤ ਜ਼ਿਆਦਾ ਦਾਗ ਪੈ ਗਏ ਜਿਸ ਕਰਕੇ ਮੈਨੂੰ ਡੋਕਟਰ ਤੱਕ ਜਾਣ ਦੀ ਜ਼ਰੂਰਤ ਤੱਕ ਪੈ ਗਈ ਅਤੇ ਮੈਂ ਇਸ ਤੋਂ ਬਿਲਕੁਲ ਵੀ ਸੰ ਸੰਤੁਸ਼ਟ ਨਹੀਂ ਹਾਂ ਅਤੇ ਅਗਰ ਕੋਈ ਵੀ ਮੈਨੂੰ ਤੁਹਾਡੀ ਵੈੱਬਸਾਈਟ ਦੇ ਬਾਰੇ ਪੁੱਛੇਗਾ ਤਾਂ ਮੈਂ ਇਹਦੇ ਬਾਰੇ ਬਿਲਕੁਲ ਵੀ ਰਿਕਮੈਂਡ ਨਹੀਂ ਕਰਾਂਗੀ ਅਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਸਾਰੇ ਪੈਸੇ ਵਾਪਸ ਦਿੱਤੇ ਜਾਣ